ਮੈਂ ਅਤੁਲ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਰੋਡਾਂ ਦਾ ਹਾਲ ਬਹੁਤ ਹੀ ਮਾੜਾ ਹੈ ਕਈ ਜਗ੍ਹਾ 'ਤੇ ਇਉਂ ਦੇ ਰੋਡ ਹਨ ਜੋ ਕਿ ਬਹੁਤ ਜ਼ਿਆਦਾ ਟੁੱਟੇ ਹਨ ਜਿੱਦਾਂ ਕਿ ਮੁਕੇਰੀਆਂ ਵਾਲਾ ਰੋਡ ਉਹ ਇੱਕ ਰੋਡ ਜੋ ਕਿ ਸਿਰਫ ਦਸ ਵੀਹ ਕਿਲੋਮੀਟਰ ਦਾ ਹੈ ਉੱਥੇ ਆਉਣ ਜਾਣ ਦੇ ਲਈ ਅੱਧੇ ਤੋਂ ਪੂਰਾ ਘੰਟਾ ਲੱਗ ਜਾਂਦਾ ਹੈ ਕਿਉਂਕਿ ਉਹ ਰੋਡ ਬਹੁਤ ਬੁਰਾ ਹੋ ਚੁੱਕਿਆ ਹੈ ਉਹਦੇ ਵਿੱਚ ਹਰ ਜਗ੍ਹਾ 'ਤੇ ਖੱਡੇ ਹੀ ਖੱਡੇ ਹਨ ਅਤੇ ਬਰਸਾਤਾਂ ਵਿੱਚ ਤਾਂ ਹੋਰ ਬੁਰਾ ਹਾਲ ਹੋ ਜਾਂਦਾ ਜਦੋਂ ਖੱਡੇ ਦਿੱਖਦੇ ਵੀ ਨਹੀਂ ਹਨ ਉਹਦੀ ਵਜ੍ਹਾ ਨਾਲ ਕਈ ਗੱਡੀਆਂ ਦਾ ਨੁਕਸਾਨ ਵੀ ਹੋ ਜਾਂਦਾ ਹੈ ਕਈ ਐਕਸੀਡੈਂਟ ਹੋ ਰਹੇ ਹਨ ਉਸ ਤੋਂ ਇਲਾਵਾ ਉਹ ਰੋਡ 'ਤੇ ਬੱਸਾਂ ਵੀ ਬਹੁਤ ਜ਼ਿਆਦਾ ਐਕਸੀਡੈਂਟ ਕਰ ਰਹੀਆਂ ਹਨ ਉਸ ਤੋੋਂ ਇਲਾਵਾ ਗੁਰਦਾਸਪੁਰ ਦੇ ਸ਼ਹਿਰੀ ਰੋਡ ਵੀ ਬਹੁਤ ਬੁਰੀ ਹਾਲਤ ਵਿੱਚ ਹੈ ਜੋ ਕਿ ਰੋਡ ਕਾਫੀ ਵੱਡੇ ਹੋਣੇ ਚਾਹੀਦੇ ਸੀ ਉਹ ਕਾਫੀ ਛੋਟੇ ਹਨ ਮੇਨ ਬਜ਼ਾਰ ਦੇ ਰੋਡਾਂ ਵਿੱਚ ਲੋਕਾਂ ਨੇ ਆਪਣੀ ਰੇਹੜੀਆਂ ਅੱਗੇ ਕਰ ਦਿੱਤੀਆਂ ਹਨ ਜਿਹਦੀ ਵਜ੍ਹਾ ਨਾਲ ਕਿ ਰੋਡ ਹੋਰ ਛੋਟੇ ਹੋ ਗਏ ਹੈ ਲੋਕ ਨਾ ਇੱਥੇ ਕੋਈ ਟਰੈਫਿਕ ਸਿਗਨਲ ਵਗੈਰਾ ਜਿਹਦੀ ਵਜ੍ਹਾ ਨਾਲ ਕਿ ਲੋਕਾਂ ਦੇ ਐਕਸੀਡੈਂਟ ਹੋਰ ਬਹੁਤ ਜ਼ਿਆਦਾ ਹੁੰਦੇ ਹੈ ਨਾਕਾ ਪੁਲਿਸ ਵੀ ਜਿਹੜੀ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰਦੀ ਹੈ ਉਸ ਤੋਂ ਇਲਾਵਾ ਰੋਡ ਛੋਟੇ ਹੋਣ ਦੇ ਕਾਰਨ ਟਰੈਫਿਕ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਿਹੜੇ ਇੱਕ ਦੋ ਕਿਲੋਮੀਟਰ ਦੇ ਰੋਡ 'ਤੇ ਪੰਜ ਦਸ ਮਿੰਟਾਂ 'ਚ ਬੰਦਾ ਅਰਾਮ ਨਾਲ ਆ ਜਾ ਸਕਦਾ ਹੈ ਉੱਥੇ ਕਦੀ ਕਦੀ ਅੱਧੇ ਘੰਟੇ ਤੋਂ ਘੰਟਾ ਤੱਕ ਲੱਗ ਜਾਂਦਾ ਹੈ ਸਿਰਫ ਆਉਣ ਜਾਣ ਦੇ ਲਈ ਕਿਉਂਕਿ ਉੱਥੇ ਇੰਨਾ ਜ਼ਿਆਦਾ ਟਰੈਫਿਕ ਹੋ ਜਾਂਦਾ ਹੈ ਉਸ ਤੋਂ ਇਲਾਵਾ ਕਈ ਲੋਕ ਬਹੁਤ ਤੇਜ਼ ਵਾਹਨ ਵੀ ਚਲਾਉਂਦੇ ਹਨ ਸ਼ ਕਿਉਂਕਿ ਇਹ ਸ਼ਹਿਰੀ ਸੜਕਾਂ ਹਨ ਇੱਥੇ ਗਲੀਆਂ ਵੀ ਬਹੁਤ ਜ਼ਿਆਦਾ ਹੈ ਅਤੇ ਲੋਕਾਂ ਦੇ ਐਕਸੀਡੈਂਟ ਇਸ ਕਰਕੇ ਬਹੁਤ ਜ਼ਿਆਦਾ ਹੋ ਰਹੇ ਹਨ ਜਿਹਦਾ ਕਿ ਪੁਲਿਸ ਨਾ ਕੋਈ ਰੋਡ ਕਰਮਚਾਰੀ ਹੱਲ ਕਰਦਾ ਹੈ ਹੋਰ ਵੀ ਜਦੋਂ ਵੀ ਕਿਤੇ ਕੋਈ ਕੰਮ ਸ਼ੁਰੂ ਹੁੰਦਾ ਹੈ ਰੋਡ ਦਾ ਉਹਦੇ ਕਰਕੇ ਬਹੁਤ ਜ਼ਿਆਦਾ ਪਿੱਛੋਂ ਤੱਕ ਸਾਰੇ ਵਾਹਨ ਨੂੰ ਰੁਕਵਾ ਦਿੱਤਾ ਜਾਂਦਾ ਹੈ ਜਿਹਦੀ ਵਜ੍ਹਾ ਨਾਲ ਕਿ ਯਾਤਾਯਾਤ ਦਾ ਬਹੁਤ ਨੁਕਸਾਨ ਹੁੰਦਾ ਹੈ ਜਿਹੜੇ ਕਿ ਲੋਕਾਂ ਨੂੰ ਕਿਤੇ ਕੰਮ 'ਤੇ ਜ਼ਰੂਰੀ ਜਾਣਾ ਹੁੰਦਾ ਹੈ ਉਨ੍ਹਾਂ ਨੂੰ ਰੋਡ ਉਹ ਵਰਤਣ ਹੀ ਨਹੀਂ ਦਿੰਦੇ ਜਿਹਦੀ ਵਜ੍ਹਾ ਨਾਲ ਉਹਨਾਂ ਨੂੰ ਛੋਟੇ ਜਾਂ ਗਲਤ ਰਸਤੇ ਅਪਣਾਉਣੇ ਪੈਂਦੇ ਹਨ ਜਿਨ੍ਹਾਂ ਵਾ ਨਾ ਕਿ ਹੋਰ ਐਕਸੀਡੈਂਟ ਹੁੰਦੇ ਹਨ ਹੁਣ ਥੋੜ੍ਹੇ ਟਾਈਮ ਪਹਿਲਾਂ ਇੱਥੇ ਇੱਕ ਪੁੱਲ ਬਣਿਆ ਜਿਹਦੇ ਕਰਕੇ ਦੋ ਸਾਲ ਦੇ ਲਈ ਉਹ ਰੋਡ ਨੂੰ ਰੋਕ ਦਿੱਤਾ ਗਿਆ ਜਿਹਦੀ ਵਜ੍ਹਾ ਨਾਲ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਨੁਕਸਾਨ ਹੋਇਆ ਹਾਲਾਂਕਿ ਹੁਣ ਉਹ ਪੁੱਲ ਬਣ ਗਿਆ ਹੈ ਫਿਰ ਵੀ ਉਹ ਕਈ ਵਾਰੀ ਲੋਕਾਂ ਨੂੰ ਰੋਕ ਦਿੰਦੇ ਹਨ ਕਹਿ ਕੇ ਕਿ ਮਤਲਬ ਅਜੇ ਪੁੱਲ ਠੀਕ ਨਹੀਂ ਹੈ ਇਸ ਕਰਕੇ ਇਹਦੇ ਵੱਲ ਦੇਖਿਆ ਜ਼ਰੂਰ ਜਾਣਾ ਚਾਹੀਦਾ ਹੈ ਅਤੇ ਇਹਦੀ ਸਾਰੀ ਚੀਜ਼ਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ